ਜਦੋਂ ਕਿ ਬੱਚੇ ਮੁੰਡਾ ਹੁੰਦਾ ਹੈਗਾ ਉਹਨੂੰ ਜਦੋਂ ਕਿ ਬਾਹਰ ਗੋਦੀ 'ਚ ਲਿਆਉਂਦਾ ਜਾਂਦਾ ਹੈ ਜਾਂ ਉਹਦੀ ਦਾਦੀ ਭੂਆ ਮਾਸੀਆਂ ਜਾਂ ਕੋਲ ਕੌਣ ਕੋਈ ਵੀ ਹੁੰਦਾ ਜਦੋਂ ਉਹਨੂੰ ਬੜੇ ਪਿਆਰ ਦੇ ਨਾਲ ਗੁੜਤੀ ਦਿੱਤੀ ਜਾਂਦੀ ਹੈ ਬੜੇ ਸਕੀਮਾਂ ਨਾਲ ਗੁੜਤੀ ਦਿੱਤੀ ਜਾਂਦੀ ਹੈ ਅਤੇ ਬੜੀਆਂ ਖੁਸ਼ੀਆਂ ਅਤੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਜਦੋਂ ਕਿ ਘਰ ਆਉਂਦੇ ਨੇ ਉਹਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਅੰਦਰ ਤੇਲ ਢਾਲ ਕੇ ਉਹਨੂੰ ਅੰਦਰ ਲਿਆਉਂਦਾ ਜਾਂਦਾ ਹੈ ਕਿ ਜਦੋਂ ਕਿ ਆਉਂਦਾ ਕੋਈ ਰਿਸ਼ਤੇਦਾਰ ਆਸੇ ਪਾਸੇ ਪੜੋਸੀ ਵਧਾਈਆਂ ਦਿੰਦੇ ਹੋਏ ਸਾਰੇ ਖੁਸ਼ ਨਜ਼ਰ ਆਉਂਦੇ ਨੇਗੇ ਅਤੇ ਜਦੋਂ ਵੀ ਉਹਨੂੰ ਆਉਂਦੇ ਨਾਨਕੇ ਆਉਂਦੇ ਹੈ ਜਦੋਂ ਉਹਨਾਂ ਦਾ ਕੋਈ ਵੀ ਫੰਕਸ਼ਨ ਕਰਦੇ ਆ ਬੱਚੇ ਦੇ ਕੱਪੜਾ ਪਾਉਣਾ ਹੁਣ ਉਹਦੇ ਸਾਰੇ ਨਾਨਕੇ ਪੰਜੀਰੀ ਲੈ ਕੇ ਆਉਂਦੇ ਨੇ ਖਿਡੌਣੇ ਕੱਪੜੇ ਲੀੜੇ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਅਤੇ ਬਹੁਤ ਹੀ ਖੁਸ਼ੀ ਅਤੇ ਪਿਆਰ ਨਾਲ ਉਹਦਾ ਨਾਮਕਰਨ ਵੀ ਕਰਦੇ ਨੇ ਅਤੇ ਨਾਮਕਰਨ ਕਰਕੇ ਜਦੋਂ ਵੀ ਆਪਣੇ ਆਉਂਦੇ ਨੇ ਅਤੇ ਬੜੀਆਂ ਖੁਸ਼ੀਆਂ ਅਤੇ ਵਧਾਈਆਂ ਮਿਲਦੀਆਂ ਹਨ ਅਤੇ ਬੱਚੇ ਦਾ ਬੜਾ ਪਿਆਰ ਨਾਲ ਨਾਂ ਰੱਖਿਆ ਜਾਂਦਾ ਹੈ ਨਾਂ ਰੱਖ ਕੇ ਅਤੇ ਜਦੋਂ ਸਾਰੇ ਮਾਮੇ ਮਾਸੀਆਂ ਨੂੰ ਜਦੋਂ ਜਾਂਦੇ ਨੇ ਵੀ ਨਾਮਕਰਨ ਕਰਕੇ ਜਾਂਦੇ ਨੇ ਸਾਰੇ ਮਾਸੀਆਂ ਤਾਏ ਚਾਚੇ ਭੂਆ ਮਾਮਿਆਂ ਨੂੰ ਬੜੇ ਪਿਆਰ ਨਾਲ ਉਹਨਾਂ ਨੂੰ ਗਿਫਟ ਵੀ ਦਿੱਤੇ ਜਾਂਦੇ ਨੇ ਮਠਿਆਈਆਂ ਹੋਰ ਕੁਝ ਹੋਰ ਜਿਵੇਂ ਜਿਵੇਂ ਕਿ ਹੁੰਦਾ ਬਹੁਤ ਖੁਸ਼ੀ ਦੇ ਪਿਆਰ ਨਾਲ ਉਹਨਾਂ ਨੂੰ ਗੀਤ ਗਾ ਕੇ ਵੀ ਖੁਸ਼ੀਆਂ ਮਨਾ ਕੇ ਵੀ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਹੈ ਅਤੇ ਬੱਚੇ ਦੀ ਬਹੁਤ ਮੁੰਡੇ ਹੋਣ ਕਰਕੇ ਜਦੋਂ ਉਹਨਾਂ ਦੇ ਛਵੀ ਵੀ ਬੰਨ੍ਹੇ ਜਾਂਦੇ ਨੇ ਉਹਨਾਂ ਦੇ ਲੱਡੂ ਵੀ ਵੰਡੇ ਜਾਂਦੇ ਨੇ ਗਲੀ ਗਵਾਂਢ ਦੇ ਵਿੱਚ ਲੱਡੂ ਵੰਡ ਕੇ ਸਾਰੇ ਬੜੇ ਖੁਸ਼ੀ ਮਨਾਉਂਦੇ ਨੇ ਜਦੋਂ ਕਿ ਫਿਰ ਵਧਾਈਆਂ ਲੈਣ ਆਉਂਦੇ ਨੇ ਸਾਰੇ ਖੁਸ਼ੀ ਖੁਸ਼ੀ ਉਹਨਾਂ ਨੂੰ ਬਹੁਤ ਹੀ ਵਧਾਈਆਂ ਦਿੱਤੀਆਂ ਜਾਂਦੀਆਂ ਹਨ